ਹਾਂ ਪੇਂਡੂ ਭਾਈਚਾਰੇ ਦੇ ਨੌਜਵਾਨ ਖੇਤੀਬਾੜੀ ਜਿਹੜੇ ਕਿੱਤਾ ਹੈਗਾ ਜਾਂ ਜੀਵਨ ਆਪਣੇ ਢੰਗ ਨਾਲ ਵਿਚਾਰਦੇ ਆ ਜਿਵੇਂ ਕਿ ਖੇਤੀਬਾੜੀ ਪਹਿਲਾਂ ਬੈੱਲਾਂ ਨਾਲ ਹੁੰਦੀ ਸੀਗੀ ਹੁਣ ਟਰੈਕਟਰ ਆ ਗਏ ਆ ਪਹਿਲਾਂ ਖੂਹ ਹਲਟ ਚਲਦੇ ਸੀਗੇ ਟੰਡਾਂ ਵਾਲੇ ਉਹਦੇ ਵਿੱਚ ਹੁਣ ਆਪਣੇ ਟਿਊਵੈੱਲ ਚੱਲ ਪਏ ਫਿਰ ਬੰਬੀਆਂ ਫਸਲਾਂ ਪਹਿਲਾਂ ਲੋਕ ਕਾਫੀ ਮੁਸ਼ੱਕਤ ਨਾਲ ਵਾਢੀ ਕਰਦੇ ਸੀ ਫਲਿਆਂ ਦੇ ਨਾਲ ਉਹਨੂੰ ਮਤਲਬ ਗਾਂਹਦੇ ਸੀਗੇ ਤਾਂ ਕਾਫੀ ਮਿਹਨਤ ਸੀ ਲੇਕਿਨ ਹੁਣ ਕੰਬੈਨ ਜਾਂ ਹੋਰ ਮਸ਼ੀਨਾਂ ਕਾਫੀ ਚੱਲ ਪਈਆਂ ਜਿਵੇਂ ਕਿ ਮਤਲਬ ਪਨੀਰੀ ਝੋਨਾ ਲਾਉਣਾ ਹੋਵੇ ਤਾਂ ਪੂਰੀ ਪਨੀਰੀ ਜਿਹੜੀ ਹੈ ਉਹ ਮਸ਼ੀਨਰੀ ਦੇ ਨਾਲ ਹੀ ਲਾਈ ਜਾਂਦੀ ਹੈ ਤਕਰੀਬਨ ਹੋਰ ਜਿੱਦਾਂ ਸਬਜ਼ੀਆਂ ਕਈ ਫਸਲਾਂ ਕੱਢੀਆਂ ਜਾਂਦੀਆਂ ਉਹਦੇ ਵਿੱਚੋਂ ਟਾਈਮ ਟੂ ਟਾਈਮ ਜਲਦੀ ਕਾਫੀ ਗਾਂਹ ਮਤਲਬ ਤਰੀਕਾ ਜਿਹੜਾ ਬਦਲ ਗਿਆ ਨੌਜਵਾਨ ਜਿਹੜੇ ਨੇ ਨੌਜਵਾਨ ਪੀੜੀ ਖੇਤੀਬਾੜੀ ਦੇ ਵਿੱਚ ਜੇਕਰ ਅਗਾਂਹ ਵਧਣ ਆਉਣ ਤਾਂ ਇਹ ਕਾਫੀ ਜਿਹੜਾ ਆਪਣੇ ਦੇਸ਼ ਦੇ ਵਿੱਚ ਤਰੱਕੀ ਕਰ ਸਕਦੇ ਆ ਧੰਨਵਾਦ